ਹਾਂਜੀ ਮੇਰੀ ਮਨਪਸੰਦ ਕਿਤਾਬ ਜਿਹਨੂੰ ਕਿ ਦਾ ਗਿਆਰ੍ਹਵੇਂ ਗੁਰੂ ਦਾ ਦਰਜਾ ਪ੍ਰਾਪਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਮੈਨੂੰ ਕਿਤਾਬ ਦੇ ਰੂਪ ਵਿੱਚ ਚਾਰ ਸੈਂਚੀਆਂ ਵਿੱਚ ਚਾਰ ਭਾਗਾਂ ਵਿੱਚ ਵੰਡੀ ਹੋਈ ਮੇਰੇ ਵਾਸਤੇ ਮੇਰੀ ਮਨਪਸੰਦ ਹੈ ਮੈਂ ਇਹਨੂੰ ਪੜ੍ਹ ਕੇ ਜਿੰਨਾਂ ਆਨੰਦ ਜਿੰਨਾਂ ਸਕੂਨ ਮਹਿਸੂਸ ਕਰਦੀ ਹਾਂ ਮੇਰੀ ਜ਼ਿੰਦਗੀ ਦੇ ਸਾਰੇ ਸਵਾਲਾਂ ਦੇ ਅਰਥ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਇੱਥੋਂ ਮਿਲਦੇ ਆ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਲਝਣਾਂ ਦਾ ਹੱਲ ਮੈਨੂੰ ਇੱਥੋਂ ਮਿਲਦਾ ਹੈ ਮੈਂ ਅਪ ਸਹਿਜ ਇਹਨੂੰ ਸਹਿਜ ਪਾਠ ਦੇ ਰੂਪ ਵਿੱਚ ਪੂਰਾ ਕਰਦੀ ਹਾਂ ਚਾਰ ਭਾਗਾਂ ਵਿੱਚ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕੋਲ ਹਨ ਚਾਰ ਭਾਗਾਂ ਵਿੱਚ ਮੈਂ ਇਹਨਾਂ ਨੂੰ ਪੂਰਾ ਕਰਦੀ ਹਾਂ ਮੈਂ ਸਾਲ ਵਿੱਚ ਇੱਕ ਜਾਂ ਦੋ ਸਹਿਜ ਪਾਠ ਕਰਦੀ ਹਾਂ ਜਿਹੜੇ ਕਿ ਮੇਰੇ ਮਨ ਨੂੰ ਬੜੀ ਸਕੂਨ ਦਿੰਦੇ ਹਨ ਬੜੀ ਤਸੱਲੀ ਦਿੰਦੇ ਆ ਇਸ ਤੋਂ ਇਲਾਵਾ ਜਿਹੜੀ ਦੂਸਰੀਆਂ ਕਿਤਾਬਾਂ ਹੈ ਜਿਵੇਂ ਕਿ ਮੈਂ ਪ ਪ੍ਰੇਮ ਚੰਦ ਦੀਆਂ ਕਿਤਾਬਾਂ ਮੈਨੂੰ ਬਹੁਤ ਪਸੰਦ ਹਨ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਮੈਨੂੰ ਬਹੁਤ ਪਸੰਦ ਹਨ ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਮੈਨੂੰ ਬਹੁਤ ਪਸੰਦ ਹਨ ਮੇਰਾ ਸਾਰਿਆਂ ਦਾ ਆਪਣੀ ਜ਼ਿੰਦਗੀ ਵਿੱਚ ਪੂਰਾ ਆਨੰਦ ਲੈ ਕੇ ਪੜ੍ਹਦੀ ਹਾਂ ਧੰਨਵਾਦ